ਹੈਲੋ ਉੱਤਮ ਰੈਸਟੋਰੈਂਟ ਤੋਂ ਬੋਲ ਰਹੇ ਹੋ ਜੀ ਸਰ ਮੈਂ ਔਡਰ ਦਿੱਤਾ ਸੀਗਾ ਮੱਖਣੀ ਦਾਲ ਮੱਖਣੀ ਦਾ ਦੋ ਨਾਨ ਸੀ ਅਤੇ ਇੱਕ ਮਿਕਸ ਵੈੱਜ ਸੀ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੇਰਾ ਔਡਰ ਤਿਆਰ ਹੈ ਜੇ ਤਿਆਰ ਹੈ ਤਾਂ ਕਿੰਨੀ ਦੇਰ ਦੇ ਵਿੱਚ ਤੁਸੀਂ ਇਸਨੂੰ ਮੇਰੇ ਤੱਕ ਭੇਜ ਦੇਵੋਂਗੇ ਥੈਂਕ ਯੂ ਜੀ ਧੰਨਵਾਦ